ਮੈਂ ਜੀ ਦੁਬਈ ਘੁੰਮਣ ਗਿਆ ਹੋਇਆ ਸੀਗਾ ਜੀ ਉੱਥੇ ਸਮੁੰਦਰ ਦੇ ਕੰਢੇ ਦੇ ਕੋਲੇ ਗਿਆ ਤਾਂ ਲਹਿਰਾਂ ਬਹੁਤ ਆਉਂਦੀਆਂ ਸੀਗੀਆਂ ਪਾਣੀ ਦੀਆਂ ਸਮੁੰਦਰ ਦੀਆਂ ਮੈਨੂੰ ਬਹੁਤ ਵਧੀਆ ਲੱਗ ਰਹੀਆਂ ਸੀਗੀਆਂ ਜੀ ਵਿੱਚ ਮੱਛੀਆਂ ਉਹਦੇ ਦੇਖਣ ਖਾਤਰ ਬਹੁਤ ਵਧੀਆ ਜਗ੍ਹਾ ਥਾਂ ਸੀ ਇੱਕ ਵਾਰੀ ਚੰਡੀਗੜ੍ਹ ਗਿਆ ਜੀ ਸਤਾਰਾਂ ਸੈਕਟਰ ਦੇ ਵਿੱਚ ਅਤੇ ਠੰਡੀ ਹਵਾ ਬਹੁਤ ਆਉਂਦੀ ਸੀ ਔਰ ਦਰਖਤ ਔਰ ਸ਼ਾਮ ਬਹੁਤ ਵਧੀਆ ਸੀਗੀ ਜੀ ਠੰਡੀ ਬਹੁਤ ਪਿਆਰੀ ਪਿਆਰੀ ਛਾਂ ਸੀਗੀ ਜੀ ਉਹ ਜਗ੍ਹਾ ਦੇ ਵਿੱਚ ਇਹ ਸਤਾਰ੍ਹਾਂ ਸੈਕਟਰ ਦੇ ਵਿੱਚ ਫਿਰ ਉਹਦੇ ਬਾਅਦ ਦਿੱਲੀ ਗਿਆ ਜੀ ਇੱਕ ਵਾਰੀ ਮੈਂ ਦਿੱਲੀ ਦੇ ਵਿੱਚ ਗਿਆ ਜੀ ਦਿੱਲੀ ਘੁੰਮ ਕੇ ਆਇਆ ਕਿਲ੍ਹੇ ਦੇ ਵਿੱਚ ਕਿਲ੍ਹੇ ਵਿੱਚ ਬਹੁਤ ਵਧੀਆ ਮੈਨੂੰ ਜਗ੍ਹਾ ਲੱਗੀ ਜੀ ਚੰਗੀ ਬਹੁਤ ਵਧੀਆ ਵਧੀਆ ਚੀਜ਼ਾਂ ਦਿਖੀਆਂ ਉਹਦੇ ਵਿੱਚ ਜੀ ਦੇਖਣ ਖਤ ਜੀ ਓਹ ਮੈਨੂੰ ਬਹੁਤ ਵਧੀਆ ਲੱਗਿਆ ਜੀ ਉਹ ਜਗ੍ਹਾ ਦੇ ਵਿੱਚੋਂ ਵੀ ਮੈਂ ਦੇਖ ਕੇ ਬਹੁਤ ਖੁਸ਼ ਹੋਇਆ ਵੀ ਇਹ ਚੀਜ਼ਾਂ ਦੇਖਣ ਵਾਲੀਆਂ ਹਨ ਜੀ ਇੱਕ ਵਾਰ ਬੰਬੇ ਗਿਆ ਸੀਗਾ ਜੀ ਬੰਬੇ ਦੇ ਏਅਰਪੋਟ ਦੇ ਵਿੱਚੋਂ ਜੀ ਮੈਂ ਬਹੁਤ ਵਧੀਆ ਚੀਜ਼ਾਂ ਦੇਖੀਆਂ ਹਨ ਜਿੱਥੇ ਉੱਥੇ ਬੈਠਣ ਨੂੰ ਅਤੇ ਹੋਰ ਚੀਜ਼ ਸਭ ਕੁਝ ਬਹੁਤ ਸਹੂਲਤਾਂ ਬਹੁਤ ਵਧੀਆ ਸੀਗੀਆਂ ਜੀ ਦੇਖ ਕੇ ਆਇਆ ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਸਨ ਜੀ ਉਹਦੇ ਵਿੱਚ ਉੱਥੇ ਪਈਆਂ ਹੋਈਆਂ ਠੀਕ ਹੈ ਜੀ ਇੱਕ ਵਾਰੀ ਹਾਂਜੀ ਬੰਬੇ ਦੇ ਵਿੱਚ ਵੀ ਘੁੰਮ ਕੇ ਆਇਆ ਜਿਵੇਂ ਜੀ ਉੱਥੇ ਵੀ ਜਾ ਕੇ ਆਇਆ ਜੀ ਏਅਰਪੋਟ 'ਤੇ ਔਰ ਦਿੱਲੀ ਦਾ ਏਅਰਪੋਟ ਵੀ ਮੈਨੂੰ ਬਹੁਤ ਵਧੀਆ ਲੱਗਿਆ ਜੀ ਉੱਥੇ ਘੁੰਮਣ ਖਾਤਰ ਜੀ ਸਪੈਸ਼ਲੀ ਗਏ ਹੋਏ ਸੀਗੇ ਸਾਰੇ ਅਸੀਂ ਬਹੁਤ ਵਧੀਆ ਹੋਟੇਲ ਸੀਗੇ ਉੱਥੇ ਨਵੀਆਂ ਗੱਡੀਆਂ ਸਨ ਜੀ ਬਹੁਤ ਵਧੀਆ ਤੋਂ ਵਧੀਆ ਦੇਖਣ ਖਾਤਰ ਔਰ ਸਬਰ ਕਰਨ ਖਾਤਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਤਾਂ ਕਰਕੇ ਬਹੁਤ ਵਧੀਆ ਚੀਜ਼ ਸੀਗੀ ਜੀ ਉਹ ਜਗ੍ਹਾ ਦੇ ਵਿੱਚ